ਹੈਲੋ ਹੈਲੋ ਹਾਂਜੀ ਗੁਡ ਆਫਟਰਨ ਆਪ ਕੌਣ ਬੋਲ ਰਹੇ ਹੋ ਕੀ ਨਾਮ ਹੈ ਹਾਂਜੀ ਕੋਈ ਗੱਲ ਨਹੀਂ ਕੀ ਨਾਮ ਹੈ ਤੁਹਾਡੇ ਪਾਪਾ ਦਾ ਹਾਂਜੀ ਹਾਂਜੀ ਹਾਂਜੀ ਜਾਣਦੀ ਹਾਂ ਮੈਂ ਹਾਂਜੀ

ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਹਾਂਜੀ ਹਾਂ ਵੈਦਰ ਫਿਲਹਾਲ ਇੱਥੇ ਮਤਲਬ ਕਿ ਸਮਰ ਚੱਲ ਰਹੀ ਹੈ ਗਰਮੀ ਵੈਸੇ ਉੱਥੇ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਹੈੈ ਨਾ ਵੀ ਇਸ ਵਾਰ ਤਾਂ ਕਿਸੇ ਟੈਂਪਰੇਚਰ ਪੰਜਾਹ ਨੂੰ ਟੱਚ ਹੋ ਗਿਆ ਸੀ ਹੈ ਨਾ ਫੀਫਟੀ ਅਪਰੋਕਸੀਮੇਟ ਹੋ ਗਿਆ ਸੀ ਮਤਲਬ ਏਸੀ ਤੋਂ ਬਿਨਾਂ ਰਹਿਣਾ ਤਾਂ ਇੰਪੋਸੀਬਲ ਹੀ ਹੋ ਗਿਆ ਬਹੁਤ ਗਰਮੀ ਪੈਂਦੀ ਹੈ ਇਹ ਵੀ ਨਹੀਂ ਇੱਕ ਠੰਡ ਨਹੀਂ ਹੁੰਦੀ ਹੈ ਨਾ ਠੰਡ ਜਦੋਂ ਆਉਂਦੀ ਆ ਉਦੋਂ ਠੰਡ ਵੀ ਬਹੁਤ ਪੈਂਦੀ ਆ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਨਾ ਇੱਕ ਤਰ੍ਹਾਂ ਨਾਲ ਬੋਡੀ ਸੁੰਨ ਜਿਹੀ ਹੋ ਜਾਂਦੀ ਆ ਨਾ ਠੰਡ ਨਾਲ ਉਹ ਚੀਜ਼ ਹੋ ਜਾਂਦੀ ਹੈ ਨਾ ਅਤੇ ਮਤਲਬ ਹਾਂਜੀ ਗਰਮੀ ਵੀ ਬਹੁਤ ਪੈਂਦੀ ਹੈ ਅਤੇ ਸਰਦੀ ਵੀ ਹਾਂਜੀ ਹਾਂਜੀ ਉਹ ਤੁਸੀਂ ਜੇ ਹੁਣ ਮਤਲਬ ਦੇਖੋ ਵੀ ਹੁਣ ਤੱਕ ਗਰਮੀ ਚੱਲ ਰਹੀ ਹੈ ਹੈ ਨਾ ਹੁਣ ਤੁਸੀਂ ਇੱਕ ਵਾਰ ਗਰਮੀ ਹਾਂਜੀ ਗਰਮੀ ਵਾਲੇ ਕਲੋਥਸ ਲੈ ਕੇ ਆਓ ਹਾਂਜੀ ਇੱਥੇ ਕੀ ਏ ਕਿ ਕਿਉਂਕਿ ਪੰਦਰ੍ਹਾਂ ਮਾਰਚ ਪੰਦਰ੍ਹਾਂ ਤੋਂ ਮਾਰਚ ਤੋਂ ਹੈ ਨਾ ਜਾਂ ਫਿਰ ਮਤਲਬ ਮਾਰਚ ਤੋਂ ਲੈ ਕੇ ਅਕਟੂਬਰ ਤੱਕ ਏਸੀ ਤਾਂ ਮਤਲਬ ਕਿ ਮਸਟ ਹੀ ਹੈ ਇਸ ਤੋਂ ਬਿਨਾਂ ਰਹਿਣਾ ਬਹੁਤ ਇੰਪੋਸੀਬਲ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਹੁਣ ਤਾਂ ਪੰਜਾਬ 'ਚ ਵੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਦੇਖੋ ਹੋਸਟਲ ਦਾ ਜਿਹੜਾ ਸ਼ੈਡਿਊਲ ਹੈ ਹੈ ਨਾ ਉਹਦੇ ਵਿੱਚ ਤਿੰਨ ਟਾਈਮ ਦਾ ਖਾਣਾ ਹੁੰਦਾ ਜਿਵੇਂ ਮੋਰਨਿੰਗ ਬ੍ਰੇਕਫਾਸਟ ਦੈਨ ਲੰਚ ਫੇਰ ਉਸ ਤੋਂ ਬਾਅਦ ਆਪਣਾ ਡਿਨਰ ਆਉਂਦਾ ਹੈ ਨਾ ਅਤੇ ਮੋਰਨਿੰਗ ਹੁੰਦਾ ਲੰਚ ਮਤਲਬ ਕਿ ਸੱਤ ਤੋਂ ਅੱਠ ਦੇ ਵਿੱਚ ਵਿੱਚ ਜਿਹਦੇ ਵਿੱਚ ਕੀ ਹੈ ਕਿ ਚਾਹ ਹੁੰਦੀ ਆ ਦਹੀਂ ਨਾਲ ਪਰਾਂਠੇ ਵਗੈਰਾ ਹੋ ਜਾਂਦੇ ਆ ਨਾ ਨੋਰਮਲ ਜਿਵੇਂ ਆਪਾਂ ਉਸ ਤੋਂ ਬਾਅਦ ਮੈਂ ਲੰਚ ਲੰਚ ਹੁੰਦਾ ਦੋ ਤੋਂ ਤਿੰਨ ਦੇ ਵਿੱਚ ਵਿੱਚ ਉਹਦੇ ਵਿੱਚ ਮਤਲਬ ਕਿ ਹੈ ਅਲੱਗ ਅਲੱਗ ਮਤਲਬ ਸਬਜ਼ੀ ਦਾਲ ਜਿਵੇਂ ਮਤਲਬ ਹੁੰਦਾ ਹੈ ਨਾ ਉਸ ਸ਼ੈਡਿਊਲ ਅਕੋਰਡਿੰਗ ਹੋ ਜਾਂਦਾ ਨਾਲ ਚਾਵਲ ਹੁੰਦੇ ਆ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੈਸੇ ਇੱਕ ਸਾਲ ਤਾਂ ਲੱਗ ਹੀ ਜਾਂਦਾ ਪਰ ਕੋਈ ਗੱਲ ਨਹੀਂ ਅਡਜਸਟ ਹੋ ਜੂਗਾ ਕੋਈ ਗੱਲ ਨਹੀਂ ਜੇ ਕੋਈ ਹੋਰ ਵੀ ਕਿਊਰੀ ਹੋਈ ਮੈਨੂੰ ਕੋਲ ਕਰ ਲਿਓ ਹਾਂਜੀ ਥੈਂਕ ਯੂ